ਹੈਲੋ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਫਤਿਹਗੜ੍ਹ ਸਾਹਿਬ ਦੇ ਅਥੋਰਿਟੀ ਬੋਲ ਰਹੇ ਹੋ ਹਾਂਜੀ ਮੈਂ ਐਕਚੁਲੀ ਕਨੇਡਾ ਤੋਂ ਆ ਰਹੀ ਸੀਗੀ ਅਤੇ ਮੈਂ ਇੱਥੇ ਦਰਸ਼ਨ ਕਰਨ ਵਾਸਤੇ ਆ ਰਹੀ ਹਾਂ ਅਤੇ ਮੈਨੂੰ ਤੁਸੀਂ ਦੱਸ ਸਕਦੇ ਹੋ ਕਿ ਆਪਾਂ ਕਦੋਂ ਆ ਸਕਦੇ ਹਾਂ ਅਤੇ ਇੱਥੇ ਰਹਿਣ ਸਹਿਣ ਦਾ ਕੀ ਪ੍ਰਬੰਧ ਹੁੰਦਾ ਆ

ਅੱਛਾ ਜੀ ਅਤੇ ਸਰ ਮੈਂ ਇੱਕ ਟੋਡਰ ਮੱਲ ਜੀ ਦੀ ਹਵੇਲੀ ਬਾਰੇ ਵੀ ਸੁਣਿਆ ਉਹਦੇ ਬਾਰੇ ਤੁਸੀਂ ਮੈਨੂੰ ਕੁਛ ਦੱਸ ਸਕਦੇ ਹੋ ਅੱਛਾ ਸਰ ਜਿਹੜੇ ਇਹ ਗੁਰਦੁਆਰੇ ਸਾਹਿਬ ਜਿਵੇਂ ਤੁਸੀਂ ਜੋਤੀ ਸਰੂਪ ਸਾਹਿਬ ਕਿਹਾ ਅਤੇ ਆਪਣਾ ਮੋਤੀਰਾਮ ਮਹਿਰਾ ਗੁਰਦੁਆਰਾ ਕਿਹਾ ਉਸ ਉਹਦਾ ਮਤਲਬ ਆਪਾਂ ਪੈਦਲ ਜਾ ਸਕਦੇ ਹਾਂ ਜਾਂ ਫਿਰ ਵਹੀਕਲ 'ਤੇ ਜਾਣਾ ਪਵੇਗਾ ਕਿੰਨਾ ਕੁ ਡਿਸਟੈਂਸ ਆ ਠੀਕ ਹੈ ਸਰ ਥੈਂਕ ਯੂ ਸਰ ਹਾਂਜੀ ਸ਼ੱਸ਼ੀਕਾਲ ਸਰ